ਭਾਰਤ ਵਿੱਚ ਬਹੁਤ ਸਾਰੇ ਮਹੱਤਵਪੂਰਨ ਤਿਉਹਾਰ ਹਨ ਅਤੇ ਬਹੁਤ ਸਾਰੀਆਂ ਛੁੱਟੀਆਂ ਹਨ ਜਿਵੇਂ ਕਿ ਦਿਵਾਲੀ ਦਾ ਤਿਉਹਾਰ ਲੋਹੜੀ ਦਾ ਤਿਉਹਾਰ ਵਿਸਾਖੀ ਦਾ ਤਿਉਹਾਰ ਬਸੰਤ ਪੰਚਮੀ ਜਨਮ ਅਸ਼ਟਮੀ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਆਦਿ ਬਹੁਤ ਸਾਰੀਆਂ ਛੁੱਟੀਆਂ ਵੀ ਹੁੰਦੀਆਂ ਹਨ ਜਿਵੇਂ ਕਿ ਪੰਦਰਾਂ ਅਗਸਤ ਦੀ ਛੁੱਟੀ ਛੱਬੀ ਜਨਵਰੀ ਦੀ ਛੁੱਟੀ ਦੋ ਅਕਤੂਬਰ ਗਾਂਧੀ ਜੈਯੰਤੀ ਦੀ ਛੁੱਟੀ ਕੁਝ ਛੁੱਟੀਆਂ ਅਤੇ ਇਤਿਹਾਸ ਸਥਾਨਕ ਵੀ ਹੁੰਦੇ ਹਨ ਕਿਉਂਕਿ ਭਾਰਤ ਦੇ ਵਿੱਚ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਬਹੁਤ ਸਾਰੇ ਭਾਂਤ ਭਾਂਤ ਦੇ ਲੋਕ ਰਹਿੰਦੇ ਹਨ ਇਸ ਤਰ੍ਹਾਂ ਵੱਖਰੇ ਵੱਖਰੇ ਰਾਜਾਂ ਦੇ ਆਪਣੇ ਤਿਉਹਾਰ ਵੀ ਹੁੰਦੇ ਹਨ ਅਤੇ ਛੁੱਟੀਆਂ ਵੀ ਹੁੰਦੀਆਂ ਹਨ ਦਿਵਾਲੀ ਇੱਕ ਮਹੱਤਵਪੂਰਨ ਤਿਉਹਾਰ ਹੈ ਇਸ ਦਿਨ ਸ਼੍ਰੀ ਰਾਮ ਜੀ ਘਰ ਵਾਪਸ ਆਏ ਸਨ ਦਿਵਾਲੀ ਆਉਣ ਦੀ ਖੁਸ਼ੀ 'ਚ ਅਸੀਂ ਕੁਛ ਦਿਨ ਪਹਿਲਾਂ ਘਰ ਦੀ ਸਫ਼ਾਈ ਕਰਨ ਲੱਗ ਜਾਂਦੇ ਹਾਂ ਦਿਵਾਲੀ ਵਾਲੇ ਦਿਨ ਅਸੀਂ ਆਪਣੇ ਰਿਸ਼ਤੇਦਾਰ ਮਿੱਤਰਾਂ ਸਾਥੀਆਂ ਨੂੰ ਦਿਵਾਲੀ ਦੀ ਵਧਾਈ ਦਿੰਦੇ ਹਾਂ ਦਿਵਾਲੀ ਵਾਲੇ ਦਿਨ ਅਸੀਂ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਪੂਜਾ ਕਰਦੇ ਹਾਂ ਪੂਜਾ ਕਰਨ ਤੋਂ ਬਾਅਦ ਅਸੀਂ ਘਰ ਵਿੱਚ ਦੀਵੇ ਅਤੇ ਮੋਮਬੱਤੀਆਂ ਲਗਾਉਂਦੇ ਹਨ ਵਿਸਾਖੀ ਦਾ ਮੇਲਾ ਕੁਝ ਇਤਿਹਾਸਕ ਘਟਨਾਵਾਂ ਨਾਲ਼ ਜੁੜਿਆ ਹੋਇਆ ਹੈ ਵਿਸਾਖੀ ਦਾ ਤਿਉਹਾਰ ਤੇਰਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਸ਼੍ਰੀ ਗਊ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਵਿਸਾਖੀ ਦਾ ਮੇਲਾ ਦਾ ਸੰਬੰਧ ਕਿਸਾਨਾਂ ਨਾਲ਼ ਜ਼ਿਆਦਾ ਹੈ ਕਿਸਾਨਾਂ ਦੀ ਕਣਕ ਦੀ ਫ਼ਸਲ ਪੱਕ ਜਾਣ 'ਤੇ ਤਿਆਰ ਹੋ ਜਾਂਦੀ ਹੈ ਫ਼ਸਲ ਪੱਕਣ ਦੀ ਖੁਸ਼ੀ 'ਚ ਕਿਸਾਨ ਨੱਚ ਉੱਠਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਲੋਹੜੀ ਦਾ ਤਿਉਹਾਰ ਤੇਰਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ ਲੋਹੜੀ ਨੂੰ ਅਸੀਂ ਆਂਢ ਗੁਆਂਢ ਇਕੱਠਾ ਹੋ ਕੇ ਲੋਹੜੀ ਬਾਲਦੇ ਹਾਂ ਅਸੀਂ ਸਾਰੇ ਮਿਲ ਕੇ ਰਿਉੜੀਆਂ ਮੂੰਗਫਲੀਆਂ ਖਾਂਦੇ ਹਾਂ ਇਸ ਤਰ੍ਹਾਂ ਲੋਹੜੀ ਏਕਤਾ ਦਾ ਪ੍ਰਤੀਕ ਹੈ ਲੋਹੜੀ ਤੋਂ ਪਹਿਲਾਂ ਕਾਫ਼ੀ ਠੰਡ ਹੁੰਦੀ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਲੋਹੜੀ ਵਾਲੇ ਦਿਨ ਠੰਡ ਖ਼ਤਮ ਹੋ ਜਾਵੇਗੀ ਬਸੰਤ ਵਾਲੇ ਦਿਨ ਅਸੀਂ ਆਪਣੇ ਘਰਾਂ ਦੀ ਛੱਤਾਂ ਉੱਪਰ ਚੜ੍ਹ ਕੇ ਪਤੰਗ ਚੜਾਉਂਦੇ ਹਾਂ ਅਸੀਂ ਇੱਕ ਦੂਜੇ ਦੀ ਪਤੰਗ ਨਾਲ਼ ਪੇਚਾ ਪਾਉਂਦੇ ਹਾਂ ਪਤੰਗ ਕੱਟਦੇ ਹਾਂ ਅਤੇ ਆਨੰਦ ਮਾਣਦੇ ਹਾਂ